ਪੰਜਾਬ ਵਿੱਚ ਨਿੱਜੀ ਸਿੱਖਿਆ ਦੇ ਬਹੁਤ ਸਾਰੇ ਵਿਕਲਪ ਹਨ ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਜਿਹੜੇ ਬਾਹਰੋਂ ਲੋਕ ਆਉਂਦੇ ਹਨ ਤਾਂ ਉਹ ਗੌਵਰਮੈਂਟ ਸਕੂਲ ਵਿੱਚ ਹੀ ਪੈ ਕੇ ਪੰਜਾਬੀ ਸਿੱਖ ਸਕਦੇ ਹਨ ਅਤੇ ਸਰਕਾਰ ਨੇ ਸਾਨੂੰ ਬਹੁਤ ਸਹੂਲਤਾਂ ਦਿੱਤੀਆਂ ਹਨ ਜਿਵੇਂ ਕਿ ਸਾਨੂੰ ਬਹੁਤ ਸਕੋਲਰਸ਼ਿਪ ਦਿੱਤੀਆਂ ਹਨ ਹੈ ਅਤੇ ਉਹਨਾਂ ਉਹ ਉਹ ਆਪਾਂ ਇਸਤੇਮਾਲ ਕਰ ਸਕਦੇ ਹਾਂ ਪਰ ਪ ਪ੍ਰਾਈਵੇਟ ਸਕੂਲਾਂ ਜਾਂ ਪ ਪ੍ਰਾਈਵੇਟ ਕੋਲਜਾਂ ਵਿੱਚ ਇਹ ਸਭ ਨਹੀਂ ਹੈ ਸਾਨੂੰ ਪੂਰੇ ਦੇ ਪੂਰੇ ਪੈਸੇ ਦੇਣੇ ਪੈਂਦੇ ਹਨ ਅਤੇ ਅਸੀਂ ਇਹ ਵੀ ਦੇ ਇਹ ਵੀ ਦੇਖਦੇ ਹਾਂ ਕਿ ਜਿਹੜੇ ਅਮੀਰ ਅਮੀਰ ਹੁੰਦੇ ਹਨ ਜਾਂ ਜਿੰਨ੍ਹਾਂ ਕੋਲ ਪੈਸਾ ਹੁੰਦਾ ਹੈ ਉਹ ਲਾਈਨਾਂ ਵਿੱਚ ਨਹੀਂ ਲੱਗਦੇ ਅਤੇ ਉਹ ਅੱਗੇ ਵੱਧ ਜਾਂਦੇ ਹਨ ਜਾਂ ਜਿਵੇਂ ਆਪਾਂ ਕੋਈ ਫਾਰਮ ਭਰਦੇ ਹਨ ਤਾਂ ਉਹ ਜਿਨ੍ਹਾਂ ਕੋਲ ਪੈਸੇ ਨਹੀਂ ਹੁੰਦੇ ਅ ਮੀਨਿੰਗ ਕਿ ਜਿਹੜੇ ਨੀ ਨੀਵੇਂ ਨੀਚੇ ਲੈਵਲ ਦੇ ਹੁੰਦੇ ਹਨ ਘੱਟ ਲੈਵਲ ਦੇ ਹੁੰਦੇ ਹਨ ਤਾਂ ਉਹ ਨਹੀਂ ਕਰ ਅ ਮੀਨਿੰਗ ਕਿ ਲਾ ਉਹਨਾਂ ਨੂੰ ਲਾਈਨਾਂ ਵਿੱਚ ਲੱਗਣਾ ਪੈਂਦਾ ਹੈ ਅਤੇ ਜਿਹੜੇ ਉੱਚੀ ਜਾਤ ਦੇ ਹੁੰਦੇ ਹਨ ਉਹ ਸਿੱਧਾ ਹੀ ਨਾ ਲਾਈਨਾਂ ਵਿੱਚ ਲੱਗਦੇ ਹਨ ਅਤੇ ਸਿੱਧਾ ਹੀ ਉਹਨਾਂ ਕੋਲ ਜਾ ਕੇ ਜਿਨ੍ਹਾਂ ਦੀ ਪਹੁੰਚ ਹੁੰਦੀ ਹੈ ਉਹ ਸਿੱਧਾ ਹੀ ਉੱਥੇ ਫਾਰਮ ਭਰ ਲੈਂਦੇ ਹਨ ਅਸੀਂ ਇਹ ਵੀ ਦੇਖ ਸਕਦੇ ਹਾਂ ਕਿ ਸਾਡੇ ਵਿੱਚ ਬਹੁਤ ਇਹ ਸਭ ਬਹੁਤ ਚੱਲ ਰਿਹਾ ਹੈ ਅਤੇ ਅਸੀਂ ਇਹ ਵੀ ਦੇਖਦੇ ਹਾਂ ਕਿ ਸਾਡੇ ਪੰਜਾਬ ਵਿੱਚ ਸਾਡੇ ਪੰਜਾਬ ਵਿੱਚ ਬਹੁਤ ਸਾਰੇ ਟਿਊਸ਼ਨ ਸੈਂਟਰਸ ਵੀ ਹਨ ਮੀਨਿੰਗ ਕਿ ਜਿੱਥੋਂ ਆਪਾਂ ਪੜ੍ਹ ਸਕਦੇ ਹਾਂ ਅਤੇ ਅੱਗੇ ਵੱਧ ਸਕਦੇ ਹਾਂ ਅਤੇ ਹੋਰ ਇੰਗਲਿਸ਼ ਵੀ ਸਿੱਖ ਸਕਦੇ ਆ ਪੰਜਾਬੀ ਸਿੱਖਦੇ ਜਿਹੜੇ ਬਾਹਰੋਂ ਆਉਂਦੇ ਹਨ ਲੋਕ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਹੁੰਦੀ ਪਰ ਚੰਗੀ ਤਰ੍ਹਾਂ ਇਸ ਲਈ ਉਹ ਟਿਊਸ਼ਨ 'ਚ ਬਹਿ ਕੇ ਆਪਾਂ ਸਰਕਾਰੀ ਕਾਲਜ ਵਿੱਚ ਬਹਿ ਕੇ ਉਹ ਪੰਜਾਬੀ ਸਿੱਖ ਸਕਦੇ ਹਨ ਅਤੇ ਵਧੀਆ ਤੋਂ ਵਧੀਆ ਕਰ ਸਕਦੇ ਹਨ